ਪਹਿਲੋਂ ਪਹਿਲ ਭੰਗੜਾ ਵਿਸਾਖੀ ਦੇ ਮੌਕੇ 'ਤੇ ਪਾਇਆ ਜਾਂਦਾ ਸੀ ਪਰ ਹੁਣ ਜੋ ਇਹ ਪ੍ਰਚਲਤ ਹੋ ਗਿਆ ਹੈ ਕਿ ਜੋ ਵੀ ਕੋਈ ਸਾਡੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ ਉਹਨਾਂ ਵਿੱਚ ਭੰਗੜੇ ਨੂੰ ਇੱਕ ਬਹੁਤ ਮਹੱਤਤਾ ਦਿੱਤੀ ਗਈ ਹੈ ਭੰਗੜੇ ਦੇ ਕੁਝ ਸਟੈਪ ਇੱਦਾਂ ਦੇ ਹਨ ਜਿਹੜੇ ਕਿ ਸਾਡੇ ਗੱਭਰੂ ਜਿਹੜੇ ਕਰਦੇ ਹਨ ਅਤੇ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਜਿਹੜੇ ਚਾਦਰੇ 'ਤੇ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਮੈਦਾਨ ਵਿੱਚ ਆਉਂਦੇ ਹਨ ਭੰਗੜਾ ਪਾਉਣ ਲਈ ਤਾਂ ਉਹਨਾਂ ਦਾ ਅਲੱਗ ਹੀ ਰੂਪ ਹੁੰਦਾ ਹੈ ਭੰਗੜਾ ਸਾਡੇ ਹੁਣ ਅਗਾਹਾਂ ਤੇ ਅਗਾਹਾਂ ਇੰਨਾ ਪ੍ਰਚਲਿਤ ਹੋ ਗਿਆ ਹੈ ਇਹ ਹਰ ਤਰ੍ਹਾਂ ਅਤੇ ਵਿਆਹਾਂ ਸ਼ਾਦੀਆਂ 'ਤੇ ਕੋਈ ਵੀ ਫੰਕਸ਼ਨਾਂ 'ਤੇ ਇਹਨੂੰ ਪਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਅਸੀਂ ਦੇਖਦੇ ਹਾਂ ਕਿ ਪਰ ਭੰਗੜੇ ਦੀ ਇੱਕ ਅਹਿਮ ਅਲੱਗ ਹੀ ਪਹਿਚਾਣ ਹੈ ਭੰਗੜਾ ਜੋ ਹੈ ਇਹ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਵਧੀਆ ਅਤੇ ਸੁੰਦਰ ਤ ਤਰੀਕੇ ਨਾਲ